ਹੈਲੋ ਸਤਿ ਸ਼੍ਰੀ ਅਕਾਲ ਸਰ ਹਾਂਜੀ ਸਰ ਹਾਂਜੀ ਹਾਂਜੀ ਸਰ ਦੱਸੋ ਹਾਂਜੀ ਹਾਂਜੀ ਸਰ

ਹਾਂਜੀ ਸਰ ਬਹੁਤ ਜਗ੍ਹਾ ਹੈ ਮੋਹਾਲੀ ਦੇ ਅੰਡਰ ਆਉਂਦੀ ਹੈ ਅਤੇ ਜਿਵੇਂ ਚੰਡੀਗੜ੍ਹ ਵੀ ਹੈ ਇਲਾਂਟੇ ਮੋਲ ਹੈ ਗੁਰਦੁਆਰੇ ਹੈ ਘੁੰਮਣ ਲਈ ਘੁੰਮਣ ਫਿਰਨ ਲਈ ਬਹੁਤ ਸਾਰੀ ਮਾਰਕਿਟਸ ਹੈ ਤੁਸੀਂ ਇੱਥੇ ਆਉਂਗੇ ਤਾਂ ਮੈਂ ਉਦੋਂ ਤੁਹਾਨੂੰ ਸਾਰਾ ਕੁਛ ਦੱਸ ਦੇਵਾਂਗੀ ਤੁਸੀਂ ਮੈਨੂੰ ਕੌਂਟੈਕਟ ਕਰ ਲਿਓ ਹਾਂਜੀ ਸਰ ਹਾਂਜੀ ਸਰ ਕੋਈ ਗੱਲ ਨਹੀਂ ਮੈਂ ਤੁਹਾਨੂੰ ਹਰ ਇੱਕ ਜਗ੍ਹਾ ਦੇ ਗੂਗਲ ਲਿੰਕ ਭੇਜ ਦੇਵਾਂਗੀ ਤੁਸੀਂ ਮੈਨੂੰ ਐਨੀਟਾਈਮ ਕੋਲ ਕਰ ਸਕਦੇ ਹੋ ਧੰਨਵਾਦ